ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਅੱਜ ਤੁਹਾਨੂੰ ਨਵੀਨਤਮ ਤਕਨੀਕੀ ਰੋਜ਼ਾਨਾ ਅਤੇ ਨੀਵਾਂ ਨੀਤਾਵਾਂ ਨਾਲ਼ ਕਿਵੇਂ ਜੁੜਿਆ ਰਹਿਣਾ ਪਸੰਦ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਵੱਧਦਾ ਵੱਧਦਾ ਹੀ ਟੈਕਨੋਲਜੀ ਵੀ ਅੱਗੇ ਵੱਧ ਰਹੀ ਹੈ ਜਿਸ ਨਾਲ਼ ਕਿ ਅੱਜ ਕੱਲ੍ਹ ਦੇ ਬ ਸਾਰੇ ਨੌਜਵਾਨ ਬੱਚੇ ਅਤੇ ਬਜ਼ੁਰਗ ਕਿ ਸਾਰੇ ਹੀ ਇਸ ਨੂੰ ਬੜਾ ਹੀ ਪਸੰਦ ਕਰਦੇ ਹਾਂ ਜਿਵੇਂ ਕਿ ਮੋਬਾਇਲ ਫ਼ੋਨ ਸਭ ਤੋਂ ਵੱਡੀ ਚੀਜ਼ ਹੈ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਇਸ ਨਾਲ਼ ਲੋਕ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਦੂਰ ਪ ਦੂਰ ਦੂਰ ਬੈਠੇ ਬੈਠੇ ਗੱਲ ਕਰ ਸਕਦੇ ਹਨ ਮੈਸੇਜਿਸ ਵੀਡੀਓ ਕਾਲ ਵੀ ਵੀਡੀਓ ਕਾਲ ਵੀਡੀਓ ਚੈਟ ਵੋਇਸ ਕਾਲ ਮੈਸੇਜਿਸ ਕਰਦੇ ਹਨ ਅਤੇ ਕੁਝ ਲੋਕ ਇੱਦਾਂ ਇਹਦੇ ਵਿੱਚ ਯੂਟੀਊਬ ਵੀ ਰਾਹੀਂ ਆਪਣਾ ਮਨੋਰੰਜਨ ਕਰਦੇ ਹਨ ਨਾਲ਼ ਬੱਚੇ ਗੇਮਸ ਖੇਡ ਕੇ ਗਾਣੇ ਸੁਣ ਕੇ ਨਾਲ਼ ਇੱਕ ਹੋਰ ਜੋ ਟੈਕਨੋਲੋਜੀ ਦੀ ਵੱਡੀ ਦੇਣ ਹੈ ਉਹ ਐਲ ਈ ਡੀ ਜਿਹਦੇ ਨਾਲ਼ ਲੋਕ ਮਨੋਰੰਜਨ ਕਰਦੇ ਹਨ ਜਿਵੇਂ ਫ਼ੋਨ ਵਿੱਚ ਹੁੰਦਾ ਹੈ ਬਸ ਫ਼ਰਕ ਇੰਨਾ ਹੁੰਦਾ ਹੈ ਕਿ ਐਲ ਈ ਡੀ ਸਕਰੀਨ ਵੱਡੀ ਹੁੰਦੀ ਹੈ ਅਤੇ ਉਸ ਵਿੱਚ ਮਨੋਰੰਜਨ ਵਧੀਆ ਹੁੰਦਾ ਹੈ ਅਤੇ ਉਸ ਨੂੰ ਸਾਰੇ ਜਣੇ ਇਕੱਠੇ ਬੈਠ ਕੇ ਦੇਖ ਸਕਦੇ ਹਨ ਫ਼ੋਨ ਤਾਂ ਚਲੋ ਇੱਕ ਬੰਦਾ ਆਪਣਾ ਪਰਸਨਲ ਹੀ ਲਾ ਲਓ ਪਰ ਉਹ ਐਲ ਈ ਡੀ ਨੂੰ ਬੰਦਾ ਲਾ ਕੇ ਸਾਰੇ ਜਣੇ ਘਰ ਦੇਖ ਸਕਦੇ ਹਨ ਧੰਨਵਾਦ